ਹੈਲੋ ਹਾਂਜੀ ਹਰਪ੍ਰੀਤ ਸਿੰਘ ਜੀ ਬੋਲ ਰਹੇ ਜੀ ਹਾਂਜੀ ਮੈਨੂੰ ਤੁਹਾਡੇ ਨਾ ਇੱਕ ਫਰੈਂਡ ਨੰਬਰ ਦਿੱਤਾ ਸੀ ਜੀ ਹਾਂਜੀ ਹਾਂ ਅਸੀਂ ਨਾ ਪੰਜਾਬ ਆਉਣਾ ਪੰਜਾਬ ਦਾ ਸਾਨੂੰ ਅਸੀਂ ਨਾ ਪੰਜਾਬ ਦੇ ਵਿੱਚ ਕੋਈ ਧਾਰਮਿਕ ਸਥਾਨ ਨੇ ਜਿਹੜੇ ਆਪਣੇ ਉਹ ਉਹਨਾਂ ਬਾਰੇ ਜਾਣਕਾਰੀ ਲੈਣੀ ਹੈ ਅਤੇ ਜੋ ਸੱਭਿਆਚਾਰਕ ਪ੍ਰੋਗਰਾਮ ਨੇ ਉਹਨਾਂ ਵਾਸਤੇ ਵੀ ਉਹ ਦੇਖਣੇ ਨੇ ਅਸੀਂ ਬਸ ਅਗਲੇ ਹਫਤੇ ਆ ਜਾਣਾ ਜੀ ਹਾਂਜੀ ਵੀ ਕਿਹੜੇ ਕਿਹੜੇ ਇੱਥੇ ਧਾਰਮਿਕ ਸਥਾਨ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਜੀ ਜੀ

ਜੀ

ਜੀ ਜੀ ਜੀ

ਜੀ

ਹਾਂਜੀ ਅਸੀਂ ਆਉਣਾ ਅਗਲੇ ਹਫਤੇ ਅਗਲੇ ਹਫਤੇ ਆਉਣਾ ਜੀ ਅਗਲੇ ਹਫਤੇ ਆ ਕੇ ਤੁਸੀਂ ਸਾਨੂੰ ਜੋ ਵੀ ਹੈ ਸਾਰਾ ਕੁਛ ਸਾਨੂੰ ਦਿਖਾ ਦਿਓ ਹਾਂਜੀ ਓਕੇ ਜੀ